ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਂ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਬੁਲਾਡਾ ਤਹਿਸੀਲ ਦੇ ਵਿੱਚ ਰਹਿੰਦੀ ਹਾਂ ਬੁਲਾਡੇ ਦਾ ਜਿਹੜਾ ਸਰਕਾਰੀ ਹੋਸਪਿਟਲ ਹੈ ਉਹਦੇ ਵਿੱਚ ਮੈਂ ਨਹੀਂ ਕਹਿ ਸਕਦੀ ਕਿ ਚੰਗੇ ਡਾਕਟਰ ਡੋਕਟਰ ਤਾਂ ਚੰਗੇ ਹੁੰਦੇ ਹਨ ਪਰ ਉਹਨਾਂ ਨੂੰ ਵੀ ਕੁਝ ਫੈਸਿਲਿਟੀਜ਼ ਦੀ ਲੋੜ ਹੁੰਦੀ ਹੈ ਤਾਂ ਹੀ ਉਹ ਆਪਣੇ ਕਿੱਤੇ ਨੂੰ ਪੂਰੀ ਤਰ੍ਹਾਂ ਨਿਭਾ ਸਕਦੇ ਹਨ ਹਾਈਜੀਨਿਕ ਵਾਰਡ ਦੀ ਗੱਲ ਕਰੀਏ ਲੋੜੀਂਦੇ ਬੈਡਾਂ ਦੀ ਗੱਲ ਕਰੀਏ ਤਾਂ ਇਹ ਹਜੇ ਸਾਡੇ ਤਹਿਸੀਲ ਦੇ ਵਿੱਚ ਲੋੜੀਂਦੇ ਹਨ ਕਿਉਂਕਿ ਬੁਲਾਡੇ ਦੇ ਨਾਲ ਲੱਗਦੇ ਵੀ ਕਾਫੀ ਪਿੰਡ ਨੇ ਜਿੱਥੋਂ ਦੇ ਲੋਕ ਇੱਥੇ ਦਵਾਈ ਲੈਣ ਆਉਂਦੇ ਹਨ ਪਰ ਇੱਥੇ ਹਮੇਸ਼ਾ ਭੀੜ ਭੜੱਕਾ ਲੱਗਿਆ ਰਹਿੰਦਾ ਹੈ ਤੁਸੀਂ ਦੇਖੋਗੇ ਤਾਂ ਕੋਈ ਵੀ ਡਿਪਾਰਟਮੈਂਟ ਅਲੱਗ ਨਹੀਂ ਹੈ ਸਾਰੇ ਏ ਸਾਰੇ ਮਰੀਜ਼ ਇੱਕੋ ਥਾਂ 'ਤੇ ਬੈਠੇ ਹੁੰਦੇ ਹਨ ਉੱਥੇ ਹੀ ਉਹ ਟੈਸਟ ਹੋ ਰਿਹਾ ਹੁੰਦਾ ਉੱਥੇ ਹੀ ਤੁਹਾਨੂੰ ਡੋਕਟਰ ਦਵਾਈ ਦਿੰਦਾ ਹੈ ਤਾਂ ਮਤਲਬ ਏ ਬਿਮਾਰੀਆਂ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੈ ਦਵਾਈਆਂ ਦੀ ਜਦੋਂ ਗੱਲ ਕਰੀਏ ਕੁਝ ਨਾ ਕੁਝ ਦਵਾਈਆਂ ਘੱਟ ਹੀ ਹੁੰਦੀਆਂ ਨੇ ਸਾਜੋ ਸਮਾਨ ਮਤਲਬ ਹਜੇ ਬੁਲਾਡੇ ਨੂੰ ਡਿਵੈਲਪ ਕਰਨ ਦੇ ਲਈ ਹਜੇ ਬਹੁਤ ਜ਼ਰ ਜ਼ਿਆਦਾ ਚੀਜ਼ਾਂ ਦੀ ਲੋੜ ਹੈ ਜੋ ਕਿ ਕਿਉਂਕਿ ਤੁਹਾਨੂੰ ਜੇਕਰ ਤੁਹਾਨੂੰ ਕੋਈ ਇਲਾਜ ਕਰਨਾ ਪੈਂ ਇਲਾਜ ਕਰਵਾਉਣਾ ਹੈ ਤੁਸੀਂ ਤਾਂ ਤੁਸੀਂ ਕਦੇ ਵੀ ਬੁਲਾਡੇ ਦੇ ਵਿੱਚ ਰਹਿਣ ਵਾਲੇ ਕਦੇ ਵੀ ਬੁਲਾਡੇ ਆਉਣਾ ਪਸੰਦ ਨਹੀਂ ਕਰਨਗੇ ਬੁਲਾਡੇ ਦੇ ਡਾਕਟਰਾਂ ਨੂੰ ਦਿਖਾਣਾ ਪਸੰਦ ਨਹੀਂ ਕਰਦੇ ਹੋ ਜਾਂ ਤਾਂ ਮਾਨਸਾ ਭੱਜਦੇ ਨੇ ਜਾਂ ਸਭ ਤੋਂ ਜ਼ਿਆਦਾ ਹੋਰ ਜ਼ਿਆਦਾ ਵਧੀਆ ਦਿਖਾਉਣਾ ਹੋਵੇ ਤਾਂ ਬਠਿੰਡਾ ਬਠਿੰਡੇ ਤੋਂ ਬਠਿੰਡੇ ਦੇ ਵਿੱਚ ਹੀ ਐਕਚੁਅਲ ਦੇ ਵਿੱਚ ਜ਼ਿਆਦਾ ਡਾਕਟਰ ਅਵੇਲੇਬਲ ਨੇ ਮਾਨਸਾ ਦੇ ਲੋਕਾਂ ਦੇ ਲਈ ਮਾਨਸਾ ਦੇ ਵਿੱਚ ਵੀ ਕੁਝ ਕੁਝ ਨੇ ਜੋ ਕੁਝ ਕੁ ਸਪੈਸ਼ਲਿਸਟ ਹੈਗੇ ਨੇ ਬਟ ਪੂਰੇ ਤਰ੍ਹਾਂ ਆਪਾਂ ਨਹੀਂ ਕਹਿ ਸਕਦੇ ਬਹੁਤ ਸਾਰੇ ਹੋਸਪੀਟਲ ਹੈ ਜਿਹੜੇ ਤੁਹਾਨੂੰ ਬਠਿੰਡਾ ਦੇ ਵਿੱਚ ਹੀ ਵਧੀਆ ਮਿਲਣਗੇ ਜਿੱਥੇ ਅ ਕੋਈ ਐਮਰਜੈਂਸੀ ਕੇਸ ਆ ਜਾਂਦਾ ਹੈ ਤਾਂ ਬੁਲਾਡੇ ਦੇ ਡਾਕਟਰ ਉਹਦੇ ਨਾਲ ਡੀਲ ਨਹੀਂ ਕਰ ਸਕਦੇ ਤਾਂ ਇੱਦਾਂ ਦੇ ਕੁਝ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਕਿ ਸਾਨੂੰ ਇਲਾਜ ਲਈ ਮਤਲਬ ਬੁਲਾਡੇ ਦੇ ਵਿੱਚ ਹੀ ਇਲਾਜ ਸੰਭਵ ਹੋ ਸਕੇ ਧੰਨਵਾਦ